ਰਾਜ ਸਰਕਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਪਾਰਦਰਸ਼ਤਾ ਨਾਲ ਸੰਬੰਧਿਤ ਮੁੱਦਿਆਂ ਨੂੰ ਕਿਵੇਂ ਹੱਲ ਕਰ ਸਕਦੀ ਹੈ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਇਹ ਇੱਕ ਜਾਂ ਦੋ ਦਿਨ 'ਚ ਖਤਮ ਕਰਨ ਵਾਲੀ ਚੀਜ਼ ਨਹੀਂ ਹੈ ਇਹ ਕੋਈ ਕੀਟਾਣੂ ਜਾਂ ਜੀਵਾਣੂ ਨਹੀਂ ਜਿਹਨੂੰ ਅਸੀਂ ਮਾਰ ਸਕੀਏ ਭ੍ਰਿਸ਼ਟਾਚਾਰ ਜੜ੍ਹਾਂ ਵਿੱਚ ਫੈਲਿਆ ਹੋਇਆ ਪੂਰੇ ਸਿਸਟਮ ਦੀਆਂ ਇਸ ਨੂੰ ਖਤਮ ਕਰਨ ਲਈ ਸਾਰੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਇਹ ਆਪਾਂ ਕਿਸੇ ਇੱਕ ਸਰਕਾਰ ਦੇ ਉੱਤੇ ਦੋਸ਼ ਨਹੀਂ ਮੜ੍ਹ ਸਕਦੇ ਕਿ ਤੁਹਾਡੀ ਸਰਕਾਰ ਭ੍ਰਿਸ਼ਟਾਚਾਰ ਕਰਦੀ ਹੈ ਉਰੇ ਸਾਨੂੰ ਨਹੀਂ ਪਤਾ ਲੱਗਦਾ ਵੀ ਕਿਵੇਂ ਕੰਮ ਹੋ ਰਿਹਾ ਕਿਵੇਂ ਨਹੀਂ ਹੋ ਰਿਹਾ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਇਹ ਬਦਲਾਅ ਚਾਹੀਦਾ ਲੋਕਾਂ ਦੀ ਸੋਚ ਵਿੱਚ ਅੱਜ ਕੱਲ੍ਹ ਲੋਕਾਂ ਦੀ ਸੋਚ ਇਹੀ ਹੋ ਚੁੱਕੀ ਆ ਕਚਹਿਰੀ ਜਾਂਦੇ ਨੇ ਉਹ ਪੈਸੇ ਦੇ ਕੇ ਈ ਉਹਨਾਂ ਨੂੰ ਲੱਗਦਾ ਕਿ ਕੰਮ ਹੋਵੇਗਾ ਜੇ ਅਸੀਂ ਪੈਸੇ ਨਹੀਂ ਦਿੱਤੇ ਸਾਡਾ ਕੰਮ ਨਹੀਂ ਹੋਏਗਾ ਜਿਹਨਾਂ ਕੋਲ ਤਾਂ ਜ਼ਿਆਦਾ ਪੈਸਾ ਉਹ ਦੇ ਦਿੰਦੇ ਨੇ ਅਤੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਪਰ ਫਰਕ ਪੈਂਦਾ ਆਮ ਲੋਕਾਂ ਨੂੰ ਜਿਹੜੇ ਬਹੁਤ ਗਰੀਬ ਨੇ ਗਰੀਬ ਤਬਕੇ ਨਾਲ ਸੰਬੰਧਿਤ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਮੈਂ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਆਮਦਨ ਦੀ ਸਮਾਨਤਾ ਹੋਵੇ ਜੇ ਆਮਦਨ ਦੀ ਸਮਾਨਤਾ ਹੋਵੇਗੀ ਤਾਂ ਭ੍ਰਿਸ਼ਟਾਚਾਰ ਹੌਲੀ ਹੌਲੀ ਜੜ੍ਹੋਂ ਖਤਮ ਹੋ ਜਾਵੇਗਾ ਇਹ ਜੋ ਜ਼ਿਆਦਾ ਅਮੀਰ ਤਬਕਾ ਉਹ ਭ੍ਰਿਸ਼ਟਾਚਾਰ ਵਧਾ ਰਿਹਾ ਉਹ ਆਪਣਾ ਕੰਮ ਜਲਦੀ ਚਾਹੁੰਦਾ ਉਹ ਕਿਸੇ ਵੀ ਕੰਮ ਲਈ ਇੰਤਜ਼ਾਰ ਨਹੀਂ ਕਰ ਸਕਦਾ ਤਾਂ ਜੇ ਜੇ ਨਜ਼ਰ ਰੱਖਣੀ ਹੈ ਤਾਂ ਅਮੀਰ ਲੋਕਾਂ 'ਤੇ ਰੱਖੀ ਜਾਵੇ ਵੀ ਇਹਨਾਂ ਦੇ ਕੰਮ ਇੰਨੇ ਛੇਤੀ ਹੱਲ ਕਿਵੇਂ ਹੋ ਰਹੇ ਨੇ ਜੇ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਹੋ ਬਾਕੀ ਸੋਚ ਬਦਲੋ ਸਾਰਿਆਂ ਦੀ ਸਾਰੇ ਮਿਲ ਕੇ ਕੰਮ ਕਰ ਸਕਦੇ ਨੇ ਇਹ ਕੁਛ ਲੋਕਾਂ ਦਾ ਕੰਮ ਨਹੀਂ ਇਹ ਇੱਕ ਕਿਸੇ ਸਰਕਾਰ ਦਾ ਕੰਮ ਨਹੀਂ ਹੈ ਧੰਨਵਾਦ